ਸਤਿ ਸ਼੍ਰੀ ਅਕਾਲ ਮੈਂ ਪਰਮਜੀਤ ਕੌਰ ਗੁਰਦਾਸਪੁਰ ਤੋਂ ਗੱਲ ਕਰ ਰਹੀ ਹਾਂ ਹਾਂ ਮੈਂ ਮੈਂ ਮੇਰੇ ਕੋਲ ਮੇਰੀ ਮਨਪਸੰਦ ਕਿਤਾਬ ਹੈ ਜਿਸ ਨੂੰ ਜਿਸ ਕਿਤਾਬ ਨੂੰ ਧਾਰਮਿਕ ਗ੍ਰੰਥ ਮੰਨਦੀ ਹਾਂ ਉਹ ਹੈ ਗੀਤਾ ਗੀਤਾ ਪੜ੍ਹ ਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਗੀਤਾ ਵਿੱਚ ਗੀਤਾ ਇੱਕ ਐਸੀ ਕਿਤਾਬ ਹੈ ਜਿਸ ਨੂੰ ਮੇਰੇ ਵਾਰ ਵਾਰ ਪੜ੍ਹਨ ਨੂੰ ਦਿਲ ਕਰਦਾ ਹੈ ਇਸਦੇ ਵਿੱਚ ਸ਼੍ਰੀ ਕ੍ਰਿਸ਼ਨ ਦੀਆਂ ਬਾਲ ਅਵਸਥਾ ਦੀਆਂ ਗੱਲਾਂ ਅਤੇ ਉਹਨਾਂ ਦੇ ਵੱਡੇ ਹੋਣ 'ਤੇ ਜੋ ਲੀਲਾ ਕੀਤੀਆਂ ਸਨ ਉਹਨਾਂ ਬਾਰੇ ਦੱਸਿਆ ਗਿਆ ਹੈ ਅਤੇ ਮੇਰਾ ਦਿਲ ਕਰਦਾ ਹੈ ਕਿ ਮੈਂ ਇਹ ਲੀਲਾ ਵਾਰ ਵਾਰ ਦੇਖਾ ਕਿ ਮੇਰੇ ਬੱਚੇ ਅਤੇ ਮੈਂ ਵਾਰ ਵਾਰ ਇਸਨੂੰ ਪੜ੍ਹ ਕੇ ਅਤੇ ਆਪਣੀ ਜ਼ਿੰਦਗੀ ਵਿੱਚ ਉੱਨਾਂ ਗੱਲਾਂ ਦਾ ਨੂੰ ਧਾਰਨ ਕਰੀਏ ਅਤੇ ਉਹਨਾਂ ਦੇ ਪਾਏ ਪੂਰਨਾਂ 'ਤੇ ਚੱਲੀਏ ਮੇਰਾ ਦਿਲ ਕਰਦਾ ਹੈ ਕਿ ਇਸ 'ਤੇ ਕੋਈ ਫਿਲਮ ਬਣੇ ਬਣੇ ਅਤੇ ਅਤੇ ਮੈਂ ਉਸ ਨੂੰ ਫਿਲਮ ਨੂੰ ਦੇਖਾ ਧੰਨਵਾਦ